ਹੈਲੋ ਟਰੈਵਲ ਵਿਦ ਯੂ ਏਜੰਸੀ ਤੋਂ ਬੋਲਦੇ ਹੋ ਐਕਚੁਲੀ ਮੈਂ ਪਿਛਲੇ ਹਫਤੇ ਇੱਕ ਕੈਬ ਬੁੱਕ ਕੀਤੀ ਸੀ ਮੈਂ ਉਸ ਉਦੋਂ ਪਟਿਆਲੇ ਤੋਂ ਸਰਹਿੰਦ ਤੱਕ ਜਾਣਾ ਸੀ ਅਤੇ ਉਸ ਦਿਨ ਛੇ ਜਾਂ ਅੱਠ ਤਰੀਕ ਸੀ ਅਤੇ ਮੈਂ ਹੁਣ ਇਸ ਹਫਤੇ ਬਾਈ ਤਰੀਕ ਨੂੰ ਫਿਰ ਸਰਹਿੰਦ ਤੋਂ ਪਟਿਆਲੇ ਜਾਣਾ ਹੈ ਅਤੇ ਮੈਂ ਤੁਹਾਡੇ ਅੱਗੇ ਇਹ ਰਿਕੁੈਸਟ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਦੁਬਾਰਾ ਫਿਰ ਤੋਂ ਉਹੀ ਕੈਬ ਬੁੱਕ ਕਰ ਕੀਤੀ ਜਾਵੇ ਕਿਉਂਕਿ ਮੈਨੂੰ ਉਸ ਕੈਬ ਡਰਾਈਵਰ ਦਾ ਨੇਚਰ ਬਹੁਤ ਚੰਗਾ ਲੱਗਿਆ ਅਤੇ ਉਸ ਕੈਬ ਦੀ ਕੰਡੀਸ਼ਨ ਵੀ ਬਹੁਤ ਵਧੀਆ ਸੀ ਅਤੇ ਉਸ ਕੈਬ ਦਾ ਮਿਊਜ਼ਿਕ ਸਿਸਟਮ ਵੀ ਬਹੁਤ ਵਧੀਆ ਸੀ ਅਤੇ ਅਤੇ ਕੈਬ ਡਰਾਈਵਰ ਨੂੰ ਬੋਲਣ ਦੀ ਵੀ ਬਹੁਤ ਸੈਂਸ ਸੀ ਅਤੇ ਉਸ ਕੈਬ ਦਾ ਨੰਬਰ ਡਬਲ ਨਾਈਨ ਡਬਲ ਫੋਰ ਸੀ ਅਤੇ ਉਸ ਦੀ ਪੀ ਵੀ ਪਲੇਟ ਪੀ ਵੀ ਗਿਆਰਾਂ ਪਟਿਆਲੇ ਦੀ ਸੀ ਜੇਕਰ ਤੁਸੀਂ ਜੇਕਰ ਤੁਸੀਂ ਇੱਦਾਂ ਕਰ ਦੇਵੋ ਤਾਂ ਮੈਂ ਤੁਹਾਡੀ ਓਫਿਸ਼ੀਅਲ ਵੈੱਬਸਾਈਟ 'ਤੇ ਤੁਹਾਡੇ ਫੀਡਬੈਕ 'ਤੇ ਫਾਈਵ ਸਟਾਰ ਦੇਵਾਗਾਂ ਅਤੇ ਉਸ ਕੈਬ ਦਾ ਕਲਰ ਯੈਲੋ ਸੀ ਜੋ ਕਿ ਬਹੁਤ ਵਧੀਆ ਲੱਗਦਾ ਸੀ ਅਤੇ ਡੈਂਟ ਬਿਲਕੁਲ ਨਹੀਂ ਸੀ ਧੰਨਵਾਦ